ਅੱਜ ਕੱਲ ਪਿੰਡਾਂ ਦਾ ਸਭਿਅਤਾ ਸੱਭਿਆਚਾਰ ਦਿਨੋ ਦਿਨ ਘੱਟਦਾ ਜਾ ਰਿਹਾ ਹੈ ਪਿੰਡ ਦੇ ਲੋਕ ਨਾਚਾ ਨੂੰ ਵੀ ਇਹ ਬਹੁਤ ਪ੍ਰਭਾਵਿਤ ਕਰ ਰਿਹਾ ਹੈ ਪਹਿਲੇ ਦੇ ਲੋਕ ਗੀਤ ਗਾ ਕੇ ਉਸ ਦੇ ਉੱਤੇ ਨੱਚਦੇ ਸਨ ਪਰ ਅੱਜ ਕੱਲ ਉਹ ਜਗਹਾ ਡੀਜਿਆਂ ਨੇ ਲੈ ਲਈ ਹੈ ਜਿਸ ਰਾਹੀ ਲੋਕੀ ਉੱਚੀ ਉੱਚੀ ਗੀਤ ਵਜਾਉਂਦੇ ਹਨ ਤੇ ਪਤਾ ਨਹੀਂ ਕਿਹੜੀ ਇਹ ਵਿਦੇਸ਼ੀ ਨਾਚ ਨੱਚਦੇ ਹਨ ਜੋ ਕਿ ਲੋਕ ਨਾਚ ਵਿਲੁਪਤ ਹੁੰਦਾ ਜਾ ਰਿਹਾ ਹੈ ਤੇ ਉਹਨਾਂ ਲੋਕ ਨਾਚਾਂ ਵਿੱਚ ਆਪਣਾ ਹੀ ਇੱਕ ਮਜਾ ਸੀ ਜੋ ਕਿ ਦਿਨੋ ਦਿਨ ਕੱਟਤਾ ਤੇ ਆਉਣ ਵਾਲੇ ਸਮੇ ਦੇ ਵਿੱਚ ਖਤਮ ਹੋ ਜਾਵੇਗਾ